ਮੈਂ ਹੁਣ ਤੱਕ ਬੈਂਕਾਂ ਬਾਰੇ ਇਹ ਅਨੁਭਵ ਕੀਤਾ ਹੈ ਜਦੋਂ ਕੋਈ ਵੀ ਪੜ੍ਹਿਆ ਜਾਂ ਅਨਪੜ੍ਹ ਅਨਪੜ੍ਹ ਲੋਕ ਹੈ ਮਨੁੱਖ ਹੈ ਉਸ ਨੂੰ ਬੈਂਕ ਵਿੱਚ ਜਾ ਕੇ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੜ੍ਹੇ ਹੋਏ ਲੋਕਾਂ ਨੂੰ ਵੀ ਮੁਸ਼ਕਿਲਾਂ ਤਾਂ ਆਉਂਦੀਆਂ ਨੇ ਬੈਂਕ ਵਿੱਚ ਜਦੋਂ ਅਸੀਂ ਜਾਂਦੇ ਹਾਂ ਬੈਂਕ ਦੇ ਵਿੱਚ ਕਿਸੇ ਵੀ ਕਾਊਂਟਰ ਦੇ ਉੱਪਰ ਕੋਈ ਨੰਬਰ ਨਹੀਂ ਲਿਖਿਆ ਹੁੰਦਾ ਅਤੇ ਨਾ ਹੀ ਉੱਥੇ ਕੋਈ ਲਿਖਿਆ ਜਾਂਦਾ ਹੈ ਕਿ ਇਹ ਪੈਸੇ ਜਮ੍ਹਾਂ ਕਰਵਾਉਣ ਵਾਲਾ ਇਹ ਪੈਸੇ ਕਢਵਾਉਣ ਵਾਲਾ ਇਸ ਤਰ੍ਹਾਂ ਦਾ ਕੋਈ ਵੀ ਹੈਲਪ ਡੈਕਸ ਨਹੀਂ ਉੱਥੇ ਬਣਿਆ ਹੋਇਆ ਅਤੇ ਨਾ ਹੀ ਕੋਈ ਉਹਨਾਂ ਨੇ ਹੈਲਪ ਦੇ ਲਈ ਕਿਸੇ ਨੂੰ ਬਿਠਾਇਆ ਹੁੰਦਾ ਹੈ ਅਸੀਂ ਜਦੋਂ ਕਿਸੇ ਨਾਲ ਗੱਲ ਕਰਦੇ ਹਾਂ ਸਟਾਫ ਨੂੰ ਪੁੱਛਦੇ ਹਾਂ ਕਿ ਅਸੀਂ ਪੈਸੇ ਜਮ੍ਹਾਂ ਕਰਵਾਉਣੇ ਸੀ ਤਾਂ ਸਾਨੂੰ ਸਟਾਫ ਵੱਲੋਂ ਕੋਈ ਮਿਸਗਾਈਡ ਵੀ ਕੀਤਾ ਜਾਂਦਾ ਹੈ ਲੰਬੀਆਂ ਲਾਈਨਾਂ ਦੇ ਵਿੱਚ ਸਾਨੂੰ ਇੱਕ ਇੱਕ ਘੰਟਾ ਦੋ ਦੋ ਘੰਟੇ ਵੀ ਸਮਾਂ ਲਾਉਣਾ ਪੈਂਦਾ ਹੈ ਅਤੇ ਜਦੋਂ ਓ ਸਾਡੀ ਬਾਰੀ ਆਉਂਦੀ ਹੈ ਤਾਂ ਕਈ ਵਾਰੀ ਸਾਡੇ ਪੇਪਰ ਵਰਕ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਰੈਕਸ਼ਨ ਹੋ ਜਾਂਦੀ ਹੈ ਸਾਨੂੰ ਫਿਰ ਤੋਂ ਦੁਬਾਰਾ ਉਸੇ ਪ੍ਰੋਸੈਸ ਨੂੰ ਕਰਨਾ ਪੈਂਦਾ ਹੈ ਪੇਪਰ ਵਰਕ ਨੂੰ ਅਤੇ ਫਿਰ ਸਾਡੀ ਜਿਹੜੀ ਲੰਬੀ ਲਾਈਨ ਹੈ ਉਹਦੇ ਪਿੱਛੇ ਜਾ ਕੇ ਫਿਰ ਲੱਗਣਾ ਪੈਂਦਾ ਹੈ ਸਾਨੂੰ ਸਟਾਫ ਵੱਲੋਂ ਕਈ ਤਰ੍ਹਾਂ ਦੀ ਕੋਈ ਚੰਗੇ ਸੁਝਾਅ ਨਹੀਂ ਮਿਲਦੇ ਇਸ ਕਾਰਨ ਹੈ ਜਿਹੜਾ ਸਾਡਾ ਸਮਾਂ ਵੀ ਖਰਾਬ ਹੁੰਦਾ ਹੈ ਅਤੇ ਜਿਹੜੀ ਸਾਡੀ ਸੋਚ ਹੈ ਉਸ 'ਤੇ ਵੀ ਅਸਰ ਹੁੰਦਾ ਹੈ ਤਾਂ ਬੈਂਕਾਂ ਨੂੰ ਇਸ ਨੂੰ ਜਿਹੜਾ ਇਹ ਮਾੜਾ ਉੱਥੇ ਕੀਤਾ ਜਾਂਦਾ ਹੈ ਵਿਹਾਰ ਲੋਕਾਂ ਨਾਲ ਉਸ ਵੱਲ ਧਿਆਨ ਦੇਣਾ ਚਾਹੀਦਾ ਹੈ ਧੰਨਵਾਦ